ਟੈਕਨੋਲਜੀ ਬਹੁਤ ਜ਼ਿਆਦਾ ਅੱਗੇ ਵੱਧ ਗਈ ਹੈ ਅਸੀਂ ਇਹਦੇ ਨਾਲ ਅਸੀਂ ਆਪਣੇ ਘਰ ਬੈਠੇ ਕੋਈ ਵੀ ਆਨਲਾਈਨ ਕਲਾਸਾਂ ਲਗਾ ਸਕਦੇ ਹਾਂ ਕੁਝ ਵੀ ਸੋਸ਼ਲ ਮੀਡੀਆ 'ਤੇ ਸਿੱਖ ਸਕਦੇ ਹਾਂ ਜਿਵੇਂ ਕੰਪਿਊਟਰ ਕਲਾਸ ਲਗਾ ਲਈ ਬਿਊਟੇਸ਼ਨ ਕਲਾਸ ਲਗਾ ਲਈ ਸਟਿਚਿੰਗ ਕਲਾਸ ਲਗਾ ਲਈ ਇੰਗਲਿਸ਼ ਸਪੋਕਿੰਗ ਕਲਾਸ ਲਗਾ ਲਈ ਇਹਦੇ ਨਾਲ ਅਸੀਂ ਸਿੱਖ ਕੇ ਆਪਣਾ ਘਰ ਬੈਠੇ ਹੀ ਬਿਜਨਸ ਸਟਾਰਟ ਕਰ ਸਕਦੇ ਹਾਂ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਅਤੇ ਲਾਭ ਵੀ ਫਾਇਦਾ ਵੀ ਹੈ ਅਤੇ ਨੁਕਸਾਨ ਵੀ ਹੈ ਕਈ ਹੁੰਦੇ ਨੇਗੇ ਜਿਹੜਾ ਟੈਕਨੋਲੋਜੀ ਦਾ ਗਲਤ ਯੂਜ ਕਰਦੇ ਨੇ ਫੇਕ ਆਈਡੀਆਂ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਟੈਕਨੋਲੋਜੀ ਦਾ ਇੱਕ ਫਾਇਦਾ ਇਹ ਵੀ ਹੈਗਾ ਕਿ ਜਿਵੇਂ ਬਾਹਰਲੇ ਦੇਸ਼ ਗਏ ਜਿਹੜੇ ਬੱਚੇ ਨੇ ਉਹ ਆਪਣੇ ਮਾਪਿਆਂ ਨਾਲ ਔਨਲਾਈਨ ਵੀਡੀਓ ਕਾਲ ਕਰਕੇ ਉਹਨਾਂ ਨੂੰ ਆਪਣੇ ਹਾਲ ਚਾਲ ਦੱਸਦੇ ਰਹਿੰਦੇ ਨੇ ਉਹਨਾਂ ਦਾ ਹਾਲ ਚਾਲ ਪੁੱਛਦੇ ਰਹਿੰਦੇ ਨੇ ਟੈਕਨੋਲਜੀ ਇਸ ਲਈ ਬਹੁਤ ਜ਼ਿਆਦਾ ਅੱਗੇ ਵੱਧ ਗਈ ਹੈ